ਮੇਰਾ ਨਾਂ ਰਾਗਵ ਹੈ ਮੈਂ ਪਠਾਨਕੋਟ ਸ਼ਹਿਰ ਦਾ ਰਹਿਣ ਵਾਲਾ ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਘਰਦਿਆਂ ਨੇ ਇੱਕ ਸੁਖਨਾ ਕੀਤੀ ਹੋਈ ਸੀ ਕਿ ਜਿਸ ਕਰਕੇ ਮੈਨੂੰ ਧਰਮਸ਼ਾਲਾ ਜੁਆਲਾ ਜੀ ਮੱਥਾ ਟੇਕਣ ਜਾਣਾ ਹੈ ਜਿਸ ਜਿਸ ਕਾਰਣ ਮੇਰਾ ਸਾਰਾ ਪਰਿਵਾਰ ਅੱਜ ਧਰਮਸ਼ਾਲਾ ਜੁਆਲਾ ਜੀ ਮੱਥਾ ਟੇਕਣ ਜਾ ਰਹੇ ਹਨ ਅਤੇ ਉੱਥੇ ਘੁੰਮਣ ਫਿਰ ਕੇ ਅਸੀਂ ਮੱਥਾ ਟੇਕ ਕੇ ਵਾਪਿਸ ਆ ਜਾਵਾਂਗੇ ਸਾਨੂੰ ਉੱਥੇ ਗੱਡੀ ਵਿੱਚ ਜਾ ਰਹੇ ਹਾਂ ਅਤੇ ਜਾਂਦੇ ਹੋਏ ਕਈ ਨਜ਼ਾਰੇ ਦੇਖੇ ਜੁਆਲਾ ਜੀ ਦੇ ਦਰਸ਼ਨ ਕਰਦੇ ਹੀ ਅਸੀਂ ਘਰ ਨੂੰ ਵਾਪਿਸ ਆ ਰਹੇ ਸੀ ਜਿੱਥੇ ਆਉਂਦੇ ਆਉਂਦੇ ਅਸੀਂ ਕਈ ਜਗ੍ਹਾ 'ਤੇ ਰੁਕੇ ਅਤੇ ਫੋਟੋਆਂ ਖਿੱਚੀਆਂ ਫੋਟੋਆਂ ਖਿੱਚੀਆਂ ਅਤੇ ਕਈ ਬਹੁਤ ਮਜ਼ੇ ਕੀਤੇ ਅਸੀਂ ਉੱਥੇ ਕਈ ਤਰ੍ਹਾਂ ਦੀ ਡਿਸ਼ ਵੱਖਰੀ ਵੱਖਰੀ ਖਾਣ ਦੀ ਚੀਜ਼ਾਂ ਖਾਦੀਆਂ ਅਤੇ ਬਹੁਤ ਮਜ਼ਾ ਕੀਤਾ ਅਸੀਂ ਉੱਥੇ ਗੱਡੀ ਵਿੱਚ ਗਏ ਸੀ ਜਿਸ ਕਰਕੇ ਅਸੀਂ ਸਾਰਾ ਪਰਿਵਾਰ ਇਕੱਠੇ ਹੋਕਰ ਘੁੰਮ ਫਿਰਕਰ ਘਰ ਆ ਗਏ ਹਾਂ ਜੁਆਲਾ ਜੀ ਦਰਸ਼ਨ ਕਰਕੇ ਸਾਡੀ ਸੁਖਨਾ ਪੂਰੀ ਹੋ ਗਈ ਹੈ ਜੇਕਰ ਕਿਸੇ ਨੇ ਘੁੰਮਣ ਜਾਣਾ ਹੋਵੇ ਤਾਂ ਜੁਆਲਾ ਜੀ ਜਾ ਸਕਦਾ ਹੈ ਉੱਥੇ ਇੱਕ ਤਾਂ ਤੁਸੀਂ ਰੱਬ ਨੂੰ ਚੇਤਾ ਕਰਦੇ ਹੋ ਅਤੇ ਬਹੁਤ ਵਧੀਆ ਜਗ੍ਹਾ ਹੈ ਘੁੰਮਣ ਲਈ ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਜਾ ਸਕਦੇ ਹੋ